ਹਾਂਜੀ ਅਸੀਂ ਆਪਣੀ ਡਰਾਇੰਗ ਵਿੱਚ ਟੈਕਸਟ ਦੀ ਵਰਤੋਂ ਬੜੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਜਿਵੇਂ ਕਿ ਜਦੋਂ ਅਸੀਂ ਕੋਈ ਕਾਰਡ ਬਣਾਉਂਦੇ ਹਾਂ ਜਿੱਦਾਂ ਦੀਵਾਲੀ ਲਈ ਕਾਡ ਜਾਂ ਬੱਚੇ ਆਪਣੇ ਮੰਮੀਆਂ ਵਾਸਤੇ ਕੋਈ ਕਾਰਡ ਬਣਾਉਂਦੇ ਹਨ ਉਹਦੇ ਵਿੱਚ ਬੱਚੇ ਡਰਾਇੰਗ ਦੇ ਨਾਲ ਨਾਲ ਅਸੀਂ ਲਿਖ ਕੇ ਵੀ ਉਹਨੂੰ ਦਰਸ਼ਾ ਸਕਦੇ ਹਾਂ ਜਿੱਦਾਂ ਬੱਚੇ ਕਾਰਡ ਵਿੱਚ ਲਿਖਦੇ ਹਾਂ ਸਾਡੀ ਪਿਆਰੀ ਮੰਮੀ ਅਸੀਂ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਹਾਂ ਆਈ ਲਵ ਮਾਈ ਮੋਮ ਅਤੇ ਅਸੀਂ ਦਿਵਾਲੀ ਦਾ ਕਾਰਡ ਜਦੋਂ ਬਣਾਉਂਦੇ ਹਾਂ ਉੱਥੇ ਅਸੀਂ ਵਿੱਚ ਲਿਖਦੇ ਹਾਂ ਹੈਪੀ ਦਿਵਾਲੀ ਹੋਲੀ ਦਾ ਕਾਡ ਬਣਾਉਂਦੇ ਹਾਂ ਅਤੇ ਉੱਥੇ ਅਸੀਂ ਹੈਪੀ ਹੋਲੀ ਲਿਖਦੇ ਹਾਂ ਜਾਂ ਫਿਰ ਜਦੋਂ ਕਿਸੇ ਦਾ ਬਰਡੇ ਹੁੰਦਾ ਹੈ ਉਹਦੇ ਵਿੱਚ ਵੀ ਅਸੀਂ ਟੈਕਸਟ ਦੀ ਵਰਤੋਂ ਕਰਕੇ ਉਹਦਾ ਨਾਮ ਲਿਖਦੇ ਹਾਂ ਅਤੇ ਉਹਨੂੰ ਹੈਪੀ ਬਰਡੇ ਵਿਸ਼ ਕਰਦੇ ਹਾਂ ਇਸੇ ਤਰ੍ਹਾਂ ਹੀ ਅਸੀਂ ਸਟੈਂਸਲ ਵੀ ਇਸਤੇਮਾਲ ਕਰਦੇ ਹਾਂ ਸਟੈਂਸਲ ਦੇ ਨਾਲ ਵੀ ਬੜੇ ਵਧੀਆ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ ਉਹਦਾ ਨਾਮ ਵੀ ਅਤੇ ਉਹਦੇ ਵਾਸਤੇ ਕਿ ਸੋਹਣੇ ਸੋਹਣੀਆਂ ਲਾਈਨਾਂ ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ ਅਤੇ ਡਰਾਇੰਗ ਵੀ ਬੜੀ ਵਧੀਆ ਬਣਾ ਸਕਦੇ ਹਾਂ ਜਿਵੇਂ ਕਿ ਕਿਸੇ ਬੱਚੇ ਲਈ ਜਿੱਦਾਂ ਅਸੀਂ ਕਾਰਡ ਬਣਾਉਂਦੇ ਹਾਂ ਤੇ ਉਹਦੇ ਵਿੱਚ ਅਸੀਂ ਟੈਡੀ ਵੀਅਰ ਬਣਾ ਸਕਦੇ ਹਾਂ ਬੱਚੇ ਦਾ ਨਾਮ ਲਿਖਾਂਗੇ ਨਾਮ ਲਿਖ ਸਕਦੇ ਹਾਂ ਅਤੇ ਟੈਕਸਟ ਵਿੱਚ ਪਾਉਣ ਵਾਸਤੇ ਉਹਦਾ ਹੈਪੀ ਬਰਡੇ ਉਹਦਾ ਨਾਮ ਨਾਲ ਪੂਰਾ ਟੈਕਸਟ ਇਹਨੂੰ ਅਸੀਂ ਸਟੈਂਸਲ ਦੇ ਨਾਲ ਵੀ ਲਿਖ ਸਕਦੇ ਹਾਂ ਅਸੀਂ ਸਟੈਂਸ਼ਲ ਵੀ ਵਰਤ ਸਕਦੇ ਹਾਂ ਵਿੱਚ ਹੋਰ ਵੀ ਬੜਾ ਕੁਝ ਅਸੀਂ ਇਸਤੇਮਾਲ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਡਰਾਇੰਗ ਨੂੰ ਹੋਰ ਵੀ ਬਹੁਤ ਵਧੀਆ ਬਣਾਈਏ ਧੰਨਵਾਦ